ਮੇਰਾ ਇੱਕ ਮਨਪਸੰਦ ਕਵੀ ਹੈ ਜਿਸਦਾ ਨਾਮ ਹੈ ਨਰਿੰਦਰ ਸਿੰਘ ਕਪੂਰ ਇਹਨਾਂ ਦੀਆਂ ਕਹਾਣੀਆਂ ਮੈਨੂੰ ਇੰਨੀਆਂ ਪਸੰਦ ਹਨ ਕਿ ਇਹਨਾਂ ਕਹਾਣੀਆਂ ਵਿੱਚ ਰਿਐਲੀਟੀ ਦੱਸਦੇ ਹਨ ਕਿ ਸਾਡੇ ਜੀਵਨ ਵਿੱਚ ਕੀ ਵਾਪਰ ਰਿਹਾ ਅਤੇ ਸਾਡੇ ਜੀਵਨ ਦੀਆਂ ਸੱਚੀਆਂ ਕਹਾਣੀਆਂ ਉਹ ਆਪਣੀਆਂ ਇਹਨਾਂ ਕਹਾਣੀਆਂ ਰਾਹੀਂ ਪੇਸ਼ ਕਰਦੇ ਹਨ ਮੈਂ ਉਹਨਾਂ ਦੀ ਇੱਕ ਕਹਾਣੀ ਪੜ੍ਹੀ ਹੈ ਇਹਨਾਂ ਦੀ ਇੱਕ ਬੁੱਕ ਪੜ੍ਹੀ ਹੈ ਜਿਹਦਾ ਨਾਮ ਹੈ ਖਿੜਕੀਆਂ ਉਸ ਦੇ ਵਿੱਚ ਇੱਕ ਕਹਾਣੀ ਹੁੰਦੀ ਹੈ ਜਿਸਦੇ ਵਿੱਚ ਉਹ ਇੱਕ ਗੁਰੂ ਕੋਲ ਜਾਂਦੇ ਹਨ ਸ਼ਿਕਸ਼ਾ ਪ੍ਰਾਪਤ ਕਰਨ ਅਤੇ ਗੁਰੂ ਉਹਨਾਂ ਨੂੰ ਕਹਿੰਦਾ ਹੈ ਜੋ ਤੂੰ ਲਿਖਿਆ ਹੈ ਆਪਣੀ ਇੱਕ ਕਿਤਾਬ ਲੈ ਕੇ ਆ ਲਿਖ ਕੇ ਲੈ ਕੇ ਆ ਅਤੇ ਨਰਿੰਦਰ ਸਿੰਘ ਜੀ ਉਹ ਮਤਲਬ ਕਿ ਆਪਣੀ ਇੱਕ ਹਜ਼ਾਰ ਪੰਨਿਆਂ ਦੀ ਕਿਤਾਬ ਲੈ ਜਾਂਦੇ ਹਨ ਤਾਂ ਉਹਨਾਂ ਨੂੰ ਗੁਰੂ ਕਹਿੰਦਾ ਹੈ ਨਹੀਂ ਇਹਨੂੰ ਸੰਖੇਪ ਕਰਕੇ ਲੈ ਕੇ ਆ ਤਾਂ ਉਹ ਉਸਨੂੰ ਹੋਰ ਘੱਟ ਕਰਕੇ ਲਿਆਉਂਦੇ ਪੰਜਾਹ ਪੰਨੇ ਲੈ ਕੇ ਜਾਂਦੇ ਹਨ ਗੁਰੂ ਕਹਿੰਦੇ ਹਨ ਨਹੀਂ ਤੂੰ ਹੋਰ ਘੱਟ ਸੰਖੇਪ 'ਚ ਲਿਖ ਕੇ ਲੈ ਕੇ ਆ ਅਤੇ ਫੇਰ ਉਸ ਤੋਂ ਬਾਅਦ ਉਹ ਤੀਹ ਪੰਨੇ ਲੈ ਕੇ ਜਾਂਦੇ ਹਨ ਜਦੋਂ ਉਹ ਗੁਰੂ ਕੋਲ ਜਾਂਦੇ ਹਨ ਤਾਂ ਗੁਰੂ ਉਸਨੂੰ ਕਹਿੰਦਾ ਹੈ ਨਹੀਂ ਤੂੰ ਹੋਰ ਵੀ ਸੰਖੇਪ 'ਚ ਲਿਖ ਕੇ ਲੈ ਕੇ ਆ ਫੇਰ ਉਹ ਦਸ ਪੰਨੇ ਲੈ ਕੇ ਜਾਂਦੇ ਆ ਗੁਰੂ ਜੀ ਕਹਿੰਦੇ ਹਨ ਨਹੀਂ ਤੂੰ ਹੋਰ ਸੰਖੇਪ ਕਰਕੇ ਲੈ ਕੇ ਆ ਫੇਰ ਉਹ ਇੱਕ ਪੰਨਾ ਲੈ ਕੇ ਜਾਂਦਾ ਹੈ ਗੁਰੂ ਕਹਿੰਦੇ ਨਹੀਂ ਮੈਨੂੰ ਹਾਲੇ ਵੀ ਸਮਝ ਨਹੀਂ ਆ ਰਹੀ ਉਸਨੂੰ ਹੋਰ ਸੰਖੇਪ ਕਰਕੇ ਲੈ ਕੇ ਆ ਨਾ ਕਿ ਮੈਨੂੰ ਸਾਰਾ ਸਮਝ ਆਵੇ ਫੇਰ ਉਹ ਖਾਲੀ ਪੇਜ ਲੈ ਜਾਂਦੇ ਹਨ ਜਦ ਉਹ ਖਾਲੀ ਪੰਨਾ ਲੈ ਕੇ ਜਾਂਦੇ ਹਨ ਤਾਂ ਗੁਰੂ ਕਹਿੰਦਾ ਹੈ ਹਾਂ ਹੁਣ ਠੀਕ ਹੈ ਹੁਣ ਤੂੰ ਗਿਆਨ ਲੈਣ ਦੇ ਬਿਲਕੁਲ ਜੋ ਕਿ ਹੈ ਬਰਾਬਰ ਹੋ ਚੁੱਕਾ ਹੁਣ ਤੈਨੂੰ ਮੈਂ ਗਿਆਨ ਪ੍ਰਦਾਨ ਕਰ ਸਕਦਾ ਹਾਂ